ਸਤਿ ਸ਼੍ਰੀ ਅਕਾਲ ਜੀ ਮੈਂ ਮਹੀਨਾ ਪਹਿਲਾਂ ਔਨਲਾਈਨ ਕੁੜਤੀ ਮੰਗਵਾਈ ਸੀ ਅਤੇ ਉਸ ਦੀ ਪੈਕਿੰਗ ਬਹੁਤ ਵਧੀਆ ਸੀ ਅਤੇ ਉਸ ਦਾ ਰੰਗ ਵੀ ਬਹੁਤ ਵਧੀਆ ਸੀ ਜਦੋਂ ਮੈਂ ਉਹ ਪਾ ਕੇ ਦੇਖੀ ਤਾਂ ਉਹਦੀ ਫੀਟਿੰਗ ਵੀ ਬਹੁਤ ਵਧੀਆ ਸੀ ਅਤੇ ਉਸਦੀ ਕੁਆਲਿਟੀ ਵੀ ਬਹੁਤ ਵਧੀਆ ਸੀ ਉਸ ਦੀ ਸਲ ਸਟੀਚਿੰਗ ਵੀ ਬਹੁਤ ਵਧੀਆ ਕੀਤੀ ਹੋਈ ਸੀ ਉਸ 'ਤੇ ਲੈਸ ਲੱਗੀ ਹੋਈ ਸੀ ਅਤੇ ਮੈਨੂੰ ਉਹ ਬਹੁਤ ਹੀ ਪਸੰਦ ਆਈ ਅਤੇ ਇਹ ਮਾਰਕੀਟ ਦੇ ਰੇਟ ਨਾਲ਼ੋਂ ਸਸਤੀ ਮਿਲ ਗਈ ਮਾਰਕੀਟ ਵਿੱਚ ਇਹ ਮੈਨੂੰ ਪੰਜ ਸੌ ਦੀ ਮਿਲਦੀ ਸੀ ਅਤੇ ਤੁਹਾਡੇ ਤੋਂ ਮੈਨੂੰ ਤਿੰਨ ਸੌ ਦੀ ਮਿਲ ਗਈ ਸਾਰੇ ਪਰਿਵਾਰ ਨੇ ਇਹ ਕੁੜਤੀ ਬਹੁਤ ਪਸੰਦ ਕੀਤੀ ਮੇਰੀ ਕੁੜਤੀ ਨੂੰ ਵੇਖ ਕੇ ਗੁਆਂਢੀਆਂ ਨੇ ਵੀ ਔਨਲਾਈਨ ਕੁੜਤੀ ਮੰਗਵਾਈ ਅੱਗੇ ਤੋਂ ਮੈਂ ਤੁਹਾਡੇ ਤੋਂ ਕੁਝ ਨਾ ਕੁਝ ਮੰਗਵਾਉਂਦੀ ਰਹਾਂਗੀ ਤੁਹਾਡਾ ਧੰਨਵਾਦ ਜੀ